ਪੰਜਾਬੀ ਲੋਕ ਸੱਭਿਆਚਾਰਕ ਗਾਇਕ ਇਹੋ ਜਿਹੇ ਨੇ ਜੋ ਕਿ ਸੱਭਿਆਚਾਰਕ ਤਰੀਕੇ ਨਾਲ ਬਹੁਤ ਵਧੀਆ ਸਨਮਾਨ ਨਾਲ ਗਾਉਂਦੇ ਹਨ ਅਤੇ ਲੋਕ ਕਈ ਕਲਾਕਾਰ ਇਹੋ ਜਿਹੇ ਹਨ ਜੋ ਕਵਿਤਾ ਨੂੰ ਕਵਿਤਾ ਭਾਸ਼ਾ ਵਿੱਚ ਕਾਫ਼ੀ ਜ਼ਿਆਦਾ ਵਧੀਆ ਤਰੀਕੇ ਨਾਲ ਲਿਖ ਦਿੰਦੇ ਹੈ ਗਾ ਦਿੰਦੇ ਹੈ ਤਾਂ ਇਹੋ ਜਿਹੇ ਤਰੀਕੇ ਦੇ ਕਾਫੀ ਜ਼ਿਆਦਾ ਲੋਕ ਹਨ